ਮੈਂ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਇੱਕ ਦਿਨ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਉੱਥੇ ਜਾ ਕੇ ਮੈਂ ਵੇਖਿਆ ਉਹਨਾਂ ਨੇ ਗੀਜ਼ਰ ਲਗਵਾਇਆ ਹੋਇਆ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਯਾਰ ਇਹ ਗੀਜ਼ਰ ਕਿਸ ਕੰਪਨੀ ਦਾ ਹੈ ਉਹ ਉਹ ਕਹਿੰਦੇ ਕਿ ਅਸੀਂ ਔਨਲਾਈਨ ਹੀ ਮੰਗਵਾਇਆ ਹੈ ਇਹ ਐਮਾਜੋਨ ਤੋਂ ਮੰਗਵਾਇਆ ਮੈਂ ਕਿਹਾ ਚਲੋ ਮੈਂ ਘਰ ਜਾ ਕੇ ਆਪਣੇ ਬੇਟੇ ਨਾਲ ਸਲਾਹ ਕੀਤੀ ਅਤੇ ਬੇਟਾ ਕਹਿੰਦਾ ਕਿ ਚਲੋ ਪਾਪਾ ਮੰਗਵਾ ਲਓ ਮੈਂ ਘਰ ਜਾ ਕੇ ਆਪਣੀ ਫੈਮਲੀ ਨਾਲ ਸਲਾਹ ਕਰਕੇ ਗੀਜ਼ਰ ਦਾ ਔਡਰ ਔਨਲਾਈਨ ਦੇ ਤਾ ਜਦੋਂ ਔਨਲਾਈਨ ਔਡਰ ਦਿੱਤਾ ਉਹ ਆਉਂਦੇ ਆਉਂਦੇ ਹਫਤਾ ਦਸ ਦਿਨ ਲੱਗ ਗਏ ਮੈਂ ਫਿਰ ਕੰਪਨੀ ਨੂੰ ਕਾਲ ਕਰਕੇ ਪੁੱਛਿਆ ਕਿ ਬਾਈ ਮੈਂ ਇੰਨੇ ਦਿਨ ਦਾ ਔਡਰ ਦਿੱਤਾ ਹੋਇਆ ਮੇਰਾ ਔਡਰ ਹਾਲੇ ਪਹੁੰਚਿਆ ਕਿਉਂ ਨਹੀਂ ਜਦੋਂ ਦਸ ਪੰਦਰ੍ਹਾਂ ਦਿਨ ਬੀਤ ਗਏ ਫਿਰ ਮੇਰਾ ਆਰਡਰ ਘਰ ਪਹੁੰਚ ਗਿਆ ਕੰਪਨੀ ਦਾ ਬੰਦਾ ਆਇਆ ਉਹਨੇ ਫਿਟਿੰਗ ਕੀਤੀ ਪੰਜ ਚਾਰ ਦਿਨ ਗੀਜ਼ਰ ਬਹੁਤ ਹੀ ਵਧੀਆ ਚੱਲਿਆ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਮੈਂ ਕੰਪਨੀ ਨੂੰ ਦੁਬਾਰਾ ਕੌਲ ਕਰਕੇ ਸੱਦਿਆ ਕੰਪਨੀ ਦਾ ਬੰਦਾ ਆ ਕੇ ਉਸ ਨੂੰ ਠੀਕ ਕਰਕੇ ਗਿਆ ਪਰ ਲੇਕਿਨ ਉਹ ਠੀਕ ਨਹੀਂ ਹੋਇਆ ਉਹਦੇ ਕੋਈ ਫਾਲਟ ਆ ਗਿਆ ਤਾਰ ਦਾ ਫਾਲਟ ਜਾਂ ਪਾਣੀ ਗਰਮ ਨਹੀਂ ਹੁੰਦਾ ਲੇਕਿਨ ਉਸ ਬੰਦੇ ਨੇ ਦੁਬਾਰਾ ਆ ਕੇ ਉਸ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਮੈਂ ਉਸ ਗੀਜ਼ਰ ਤੋਂ ਐਨਾ ਕੁ ਪਰੇਸ਼ਾਨ ਹੋਇਆ ਕਿ ਮੈਂ ਦੋ ਚਾਰ ਦਿਨ ਆਪਣੀ ਜੋਬ 'ਤੇ ਵੀ ਨਹੀਂ ਜਾ ਸਕਿਆ ਬੇਟਾ ਕਹਿੰਦਾ ਇਸ ਗੀਜ਼ਰ ਨੂੰ ਵਾਪਸ ਕਰ ਦਿਉ ਪਰ ਲੇਕਿਨ ਮੈਂ ਦੁਬਾਰਾ ਕੰਪਨੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੇਰਾ ਗੀਜ਼ਰ ਚੇਂਜ ਕਰਕੇ ਮੈਨੂੰ ਦੇ ਦਿੱਤਾ